ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਹਾਂਜੀ ਹਾਂਜੀ ਹਾਂਜੀ ਇੱਕ ਤਾਂ ਧੂਨ ਇੰਟਰਨੈਸ਼ਨਲ ਸਕੂਲ ਬੜਾ ਫੇਮਸ ਹੈਗਾ ਆ ਇੱਕ ਇਡੀਆਣ ਇੰਟਰਨੈਸ਼ਨਲ ਸਕੂਲ ਬੜਾ ਫੇਮਸ ਹੈਗਾ ਆ ਅਤੇ ਇੱਕ ਡੀ ਪੀ ਐੱਸ ਅਤੇ ਮੈਂ ਇਹਨਾਂ ਤਿੰਨਾਂ 'ਚ ਜਾ ਕੇ ਵੈਸੇ ਇੱਕ ਵਾਰੀ ਐਡਮਿਸ਼ਨ ਦਾ ਪਤਾ ਕੀਤਾ ਹੋਇਆ ਸੀ ਅਤੇ ਮੈਨੂੰ ਸਭ ਤੋਂ ਬੈਸਟ ਮੈਨੂੰ ਉਹ ਡੀ ਪੀ ਐੱਸ ਹੀ ਲੱਗਾ ਸੀ ਇੱਕ ਮੈਨੂੰ ਪੈਂਦਾ ਵੀ ਲਾਗੇ ਹੀ ਦੂਜਾ ਮੈਨੂੰ ਇਹ ਸੀ ਕਿ ਉੱਥੇ ਬਹੁਤ ਸਾਰੀਆਂ ਬੱਚਿਆਂ ਨੇ ਫੈਸਿਲਿਟੀਜ਼ ਮਤਲਬ ਖਾਣ ਵਾਸਤੇ ਵੀ ਵਧੀਆ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਸੰਭਾਲਣ ਵਾਸਤੇ ਲੇਡੀਸ ਰੱਖੀਆਂ ਹੋਈਆਂ ਉਹਨਾਂ ਨੇ ਅਤੇ ਆਪਣੇ ਖਾਣ ਵਾਸਤੇ ਉਹਨਾਂ ਨੇ ਇੱਕ ਅਲੱਗ ਮਤਲਬ ਇੱਕ ਬਣਾਇਆ ਹੀ ਇੱਕ ਅਲੱਗ ਬੱਚਿਆਂ ਵਾਸਤੇ ਛੋਟੇ ਬੱਚਿਆਂ ਵਾਸਤੇ ਕੇਅਰਿੰਗ ਵਾਸਤੇ ਮਤਲਬ ਲੇਡੀਸ ਰੱਖੀਆਂ ਹੋਈਆਂ ਉਹਨਾਂ ਨੇ ਫਿਰ ਦੂਜੀ ਸਾਈਡ ਆਪਣੇ ਪਲੇਅ ਪਲੇਅ ਵਾਸਤੇ ਉਹਨਾਂ ਨੇ ਅਲੱਗ ਗਰਾਉਂਡ ਬਣਾਈ ਹੋਈ ਆ ਅਤੇ ਛੋਟੇ ਬੱਚਿਆਂ ਦੀ ਪਲੇਅ ਗਰਾਉਂਡ ਅਲੱਗ ਬਣਾਈ ਹੋਈ ਜਿਹਦੇ ਵਿੱਚ ਉਹਨਾਂ ਨੇ ਬੜੇ ਸਾਰੇ ਮਤਲਬ ਜਿਵੇਂ ਕਹਿ ਲਓ ਕਿ ਮਤਲਬ ਉਹਨਾਂ ਦੇ ਵਾਸਤੇ ਬਣਾਏ ਹੋਏ ਆ ਛੋਟੇ ਛੋਟੇ ਖਿਡੌਣੇ ਲਗਾਏ ਆ ਸਟੱਡੀ ਤਾਂ ਤੁਸੀਂ ਦੇਖੋ ਜੇ ਫਿਸੀਲੀਟੀਜ਼ ਆ ਤਾਂ ਫਿਰ ਸਟੱਡੀ ਵੀ ਤਾਂ ਤੁਹਾਨੂੰ ਪਤਾ ਬੈਸਟ ਹੀ ਹੋਵੇਗੀ ਉੱਥੇ ਐਂਡ ਮੈਂ ਉੱਥੇ ਜਾ ਕੇ ਖੁਦ ਵਿਜਿਟ ਕਰਕੇ ਆਪਣੇ ਬੱਚੇ ਨੂੰ ਐਡਮਿਸ਼ਨ ਕਰਵਾ ਕੇ ਆਈ ਹਾਂ ਦੋ ਤਿੰਨ ਦਿਨ ਮੈਂ ਜਾ ਕੇ ਦੇਖਿਆ ਬਾਕੀ ਉਹ ਜਿਹੜਾ ਆਪਣੀ ਯੂਨੀਫੋਰਮ ਆ ਬੁੱਕਸ ਦਾ ਖਰਚਾ ਆ ਉਹ ਆਪਾਂ ਨੂੰ ਮਤਲਬ ਬਾਹਰ ਨਹੀਂ ਜਾਣਾ ਪੈਂਦਾ ਕਿਤੇ ਉਹ ਬੁੱਕਸ ਵੀ ਉੱਥੇ ਮਿਲ ਜਾਂਦੀਆਂ ਆ ਕੁਛ ਖਾਸ ਨਹੀਂ ਬਾਹਰ ਜਾਣਾ ਪੈਂਦਾ ਉੱਥੇ ਪ੍ਰੋਵਾਈਡ ਹੋ ਜਾਂਦੀਆਂ ਬਾਕੀ ਮਤਲਬ ਫੀਸ ਦੇ ਵਿੱਚ ਹੀ ਸਾਰਾ ਕੁਛ ਇੰਕਲੂਡ ਹੋ ਜਾਂਦਾ ਆ ਹਾਂਜੀ ਬਾਕੀ ਇੱਦਾਂ ਦੀ ਕੋਈ ਟੈਂਸ਼ਨ ਨਹੀਂ ਹੈ ਮੈਂ ਆਪਣੇ ਬੱਚੇ ਉੱਥੇ ਪਾਏ ਆ ਸਕੂਲ ਵਧੀਆ ਹੈ ਸਕੂਲ ਉਹ ਹਾਂਜੀ ਹਾਂਜੀ ਨਹੀਂ ਉਹਦੀ ਬੱਸ ਸਰਵਿਸ ਵੀ ਬੱਸ ਸਰਵਿਸ ਵੀ ਵਧੀਆ ਵਾ ਉੱਥੇ ਕੋਈ ਟੈਂਸ਼ਨ ਨਹੀਂ ਹੈਗੀ ਬੱਚੇ ਨੂੰ ਲੈ ਕੇ ਜਾਂਦੇ ਪ੍ਰੋਪਰਲੀ ਛੱਡ ਕੇ ਵੀ ਜਾਂਦੇ ਆ ਕੋਈ ਇੱਦਾਂ ਦੀ ਟੈਂਸ਼ਨ ਵਾਲੀ ਗੱਲ ਨਹੀਂ ਹੈਗੀ ਬੱਚੇ ਦੀ ਕੋਈ ਖਾਸ ਟੈਂਸ਼ਨ ਨਹੀਂ ਹਾਂ ਚਲੋ ਚਲੋ ਠੀਕ ਹਾਂਜੀ ਹਾਂਜੀ ਓਕੇ ਜੀ ਵੈਲਕਮ ਵੈਲਕਮ